ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਜਿੰਮ ਟ੍ਰੇਨਰ ਬੋਲ ਰਹੇ ਹੋ ਜੀ ਆਪਾਂ ਸਰ ਤੋਂ ਬੋਲ ਰਹੇ ਹਾਂ ਸਰ ਮੈਨੂੰ ਇੱਕ ਡਾਇਟ ਚਾਹੀਦੀ ਸੀਗੀ ਆਪਣਾ ਡਾਇਟ ਪਲਾਨ ਚਾਹੀਦਾ ਸੀ ਆਪਣੇ ਲਈ ਬਲਕਿੰਗ ਕਰਨ ਲਈ ਕੋਈ ਡਾਇਟ ਪਲਾਨ ਦੇ ਸਕਦੇ ਹੋ ਤੁਸੀਂ ਸਰ ਹਾਈਟ ਸਿਕਸੀ ਏਟ ਕਹਿ ਲਓ ਅਤੇ ਅ ਏਜ ਨਾਈਨਟੀਨ ਈਅਰਸ ਸਰ ਕੋਈ ਸਪੈਸ਼ਲ ਰੂਟੀਨ ਨਹੀਂ ਹੈਗੀ ਨੋਰਮਲ ਜਿਵੇਂ ਨੋਰਮਲ ਪਰਸਨ ਡੇਲੀ ਫੂਡ ਸਿੰਪਲ ਹੀ ਆ ਕੋਈ ਸਪੈਸ਼ਲ ਰੂਟੀਨ ਨਹੀਂ ਹੈਗੀ ਹਾਂਜੀ ਸਰ ਹਾਂਜੀ ਹਾਂਜੀ ਸਰ

ਹਾਂਜੀ ਸਰ ਹਾਂਜੀ ਸਰ ਹਾਂਜੀ ਹਾਂਜੀ

ਹਾਂ ਸਰ ਜਿਮ ਮੈਂ ਸਰ ਜਿਮ ਜੇ ਨਾ ਜੁਆਇਨ ਕਰਨੀ ਹੋਵੇ ਘਰ ਫਿਟਨੈਸ ਦੀ ਕੋਈ ਡਾਇਟ ਹੋਵੇ ਮਤਲਬ ਬਿਨਾਂ ਜਿਮ ਜੁਆਇਨ ਕਰੇ ਵਲਕਿੰਗ ਲਈ ਵੈਸੇ ਮੇਜਰ

ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਜੋ ਪਲੈਂਕ ਆ ਇਹ ਵੇਟ ਲੂਜ਼ ਲਈ ਨਹੀਂ ਹੁੰਦਾ ਕਿ ਇਹਦੇ ਨਾਲ ਓਕੇ ਸਰ ਹਾਂਜੀ ਸਟੈਮੀਨਾ ਵੀ ਇੰਨਕਰੀਜ ਕਰਦਾ ਹੋਊ

ਹਾਂਜੀ ਸਰ ਅਤੇ ਸਰ ਕੋਈ ਦੇਸੀ ਡਾਇਟ ਕਹਿ ਲਓ ਉਸ ਟਾਈਪ ਦੀ ਡਾਈਟ ਮਿਲ ਸਕਦੀ ਹੈ ਮਤਲਬ

ਹਾਂਜੀ ਕਿਵੇਂ ਸਰ ਰੈਗੂਲਰ ਐਕਸਰਸਾਈਜ਼ ਨਾਲ ਥਕਾਵਟ ਹੁੰਦੀ ਮਤਲਬ ਵਿੱਚ ਰੈਸਟ ਵੀ ਚਾਹੀਦੀ ਆ ਮਤਲਬ ਹਫ਼ਤੇ ਵਿੱਚ ਪੰਜ ਦਿਨ ਐਕਸਾਈਜ਼ ਕਰ ਲਈ ਇੱਦਾਂ ਕੋਈ ਰੂਟੀਨ ਤਾਂ ਨਹੀਂ ਚਾਹੀਦੀ ਸਰ ਹਾਂਜੀ ਹਾਂਜੀ ਸਰ ਵੀ ਬਹੁਤ ਜ਼ਿਆਦਾ ਐਕਸਰਸਾਈਜ਼ ਵੀ ਵੇਟ ਲੂਜ਼ ਨੂੰ ਕੋਸ ਕਰਦੀ ਆ ਆਪਾਂ ਮਤਲਬ ਕਿੰਨਾ ਕੁ ਐਕਸਰਸਾਈਜ਼ ਰੋਜ਼ ਦੀ ਕਿੰਨੇ ਕੁ ਟਾਈਮ ਐਕਸਰਸਾਈਜ਼ ਕਰਨੀ ਚਾਹੀਦੀ ਆ ਫੋਟੀ ਫਾਈਵ ਮਿਨਟਸ ਹਾਂਜੀ ਸਰ ਮਤਲਬ ਕਾਫੀ ਹੈਲਪ ਕਰੂਗੀ ਇੱਦਾਂ ਫਿਰ ਬਲਕਿੰਗ ਲਈ ਹਾਂਜੀ ਜੇ ਸਰ ਆਪਾਂ ਮਤਲਬ ਤੁਸੀਂ ਮੇਰੇ ਘਰ ਆ ਸਕਦੇ ਹੋ ਟ੍ਰੇਨਿੰਗ ਲਈ ਐਜ ਏ ਪਰਸਨਲ ਟਰੇਨਰ ਹਾਂਜੀ ਸਰ ਕਿੰਨੀ ਸ਼ਾਮ ਦੇ ਟਾਈਮਿੰਗ ਕਿੰਨੇ ਕੁ ਵਜੇ ਦੀ ਹੋ ਸਕਦੀ ਹੈ ਸਰ ਸੱਤ ਤੋਂ ਅੱਠ ਹਾਂਜੀ ਸਰ ਬਸ ਫਿਰ ਠੀਕ ਆ ਸਰ ਕੋਈ ਨਾ ਮੈਂ ਤੁਹਾਨੂੰ ਫਿਰ ਦੁਬਾਰਾ ਕਾਲ ਕਰੂੰਗਾ ਸਰ ਠੀਕ ਆ ਸਤਿ ਸ਼੍ਰੀ ਅਕਾਲ ਸਰ ਠੀਕ ਹੈ ਸਰ ਸਤਿ ਸ਼੍ਰੀ ਅਕਾਲ